ਪੰਜਾਬ ਦੇ ਪਿੰਡਾਂ ਦੇ ਵਿੱਚ ਮੌਸਮ ਦਾ ਲੋਕਾਂ ਦੀ ਸਿਹਤ 'ਤੇ ਬਹੁਤ ਅੱਛਾ ਚੰਗਾ ਬਦਲਾਅ ਆਉਂਦਾ ਹੈ ਅੱਜ ਕੱਲ੍ਹ ਪੰਜਾਬ ਦੇ ਪਿੰਡਾਂ ਦੇ ਵਿੱਚ ਅਤੇ ਸ਼ਹਿਰਾਂ ਦਾ ਸ਼ਹਿਰਾਂ ਵਿੱਚ ਮੌਸਮ ਦਾ ਬਹੁਤ ਹੀ ਫਰਕ ਹੈ ਪਿੰਡਾਂ ਦੇ ਵਿੱਚ ਆਪਾਂ ਨੂੰ ਹਵਾ ਬਹੁਤ ਸਾਫ ਅਤੇ ਸੁਥਰੀ ਮਿਲਦੀ ਹੈ ਅਤੇ ਆਪਾਂ ਨੂੰ ਰਹਿਣ ਸਹਿਣ ਦਾ ਬਹੁਤ ਹੀ ਚੰਗਾ ਹੈਗਾ ਜਿਹਦੇ ਨਾਲ ਆਕਸੀਜਨ ਬਹੁਤ ਹੀ ਵਧੀਆ ਹੁੰਦੀ ਹੈ ਅਤੇ ਦਰਖਤ ਵੀ ਪਿੰਡਾਂ ਵਿੱਚ ਬਹੁਤ ਹੁੰਦੇ ਹਨ ਜਿਹਦੇ ਨਾਲ ਸਾਨੂੰ ਸਾਡੀ ਸਿਹਤ ਦਾ ਸੰਭਾਲ ਚੰਗੀ ਤਰ੍ਹਾਂ ਹੁੰਦੀ ਹੈ ਇ ਉਹਦੇ ਮੁਕਾਬਲੇ ਸਾਨੂੰ ਸ਼ਹਿਰਾਂ ਦੇ ਵਿੱਚ ਬਹੁਤ ਹੀ ਦਰਖਤ ਬਹੁਤ ਘੱਟ ਹੁੰਦੇ ਹਨ ਅਤੇ ਸ਼ਹਿਰਾਂ ਵਿੱਚ ਫੈਕਟਰੀਆਂ ਬਹੁਤ ਹੁੰਦੀਆਂ ਹਨ ਫੈਕਟਰੀਆਂ ਦੇ ਨਾਲ ਸ਼ਹਿਰ ਦੀ ਹਵਾ ਬਹੁਤ ਹੀ ਗੰਦਲੀ ਹੋ ਜਾਂਦੀ ਹੈ ਜਿਹਦੇ ਨਾਲ ਸਾਨੂੰ ਕਈ ਵਾਰੀ ਸਾਹ ਲੈਣਾ ਵੀ ਬੜਾ ਔਖਾ ਹੋ ਜਾਂਦਾ ਹੈ ਅਤੇ ਇਹਨਾਂ ਦੇ ਵਿੱਚ ਕਈ ਵਾਰੀ ਸਾਨੂੰ ਸਰਦੀਆਂ ਦੇ ਵਿੱਚ ਵੀ ਗਰਮੀਆਂ ਵਰਗਾ ਮਾਹੌਲ ਨਜ਼ਰ ਆਉਂਦਾ ਹੈ ਇਹਦੇ ਵਿੱਚ ਕਈ ਵਾਰੀ ਸਾਨੂੰ ਸ਼ਹਿਰਾਂ ਦੇ ਵਿੱਚ ਜਿੱਦਾਂ ਗਰਮੀਆਂ ਦੇ ਵਿੱਚ ਧੁੰਦ ਪਈ ਹੁੰਦੀ ਹੈ ਇਸ ਤਰ੍ਹਾਂ ਦਾ ਵੀ ਮਾਹੌਲ ਮ ਮੌਸਮ ਨਜ਼ਰ ਆਉਂਦਾ ਹੈ ਜਦੋਂ ਕਿ ਇਹਦੇ ਮੁਕਾਬਲੇ ਸ਼ਹਿਰਾਂ ਦੇ ਵਿੱਚ ਇਹ ਪਿੰਡਾਂ ਦੇ ਵਿੱਚ ਮੌਸਮ ਬਹੁਤ ਹੀ ਵਧੀਆ ਹੁੰਦਾ ਹੈ ਪਿੰਡਾਂ ਦੇ ਵਿੱਚ ਅਸੀਂ ਠੰਢ ਵੀ ਬਹੁਤ ਹੁੰਦੀ ਹੈ ਅਤੇ ਗਰਮੀ ਵੀ ਬਹੁਤ ਹੁੰਦੀ ਹੈ ਅਤੇ ਸ਼ਹਿਰਾਂ ਦੇ ਵਿੱਚ ਤਾਂ ਠੰਢ ਬਹੁਤ ਘੱਟ ਹੁੰਦੀ ਹੈ ਗਰਮੀ ਹੁੰਦੀ ਹੈ ਸ਼ਹਿਰਾਂ ਦਾ ਮੌਸਮ ਪਿੰਡਾਂ ਦਾ ਮੌਸਮ ਦਾ ਬਹੁਤ ਫਰਕ ਹੈ ਇਹਦਾ ਸਾਡੇ ਜੀਵਨ ਦੇ ਵਿੱਚ ਅਸੀਂ ਸ਼ਹਿਰਾਂ ਦੇ ਵਿੱਚ ਫੈਕਟਰੀਆਂ ਬਹੁਤ ਹੁੰਦੀਆਂ ਹਨ ਫੈਕਟਰੀਆਂ ਦੇ ਕਾਰਨ ਪਲਿਊਸ਼ਨ ਦੀ ਸਮੱਸਿਆ ਬਹੁਤ ਵੱਧ ਜਾਂਦੀ ਹੈ ਜਿਹਦੇ ਨਾਲ ਅਸੀਂ ਸਾਹ ਲੈਣਾ ਬੜਾ ਔਖਾ ਹੁੰਦਾ ਹੈ ਇਸ ਕਰਕੇ ਸਾਨੂੰ ਪਿੰਡਾਂ ਦਾ ਜੀਵਨ ਬਹੁਤ ਹੀ ਵਧੀਆ ਹੁੰਦਾ ਹੈ ਜਿਹਦੇ ਨਾਲ ਅਸੀਂ ਹਵਾ ਹਵਾ ਦੀ ਬਹੁਤ ਹੀ ਵਧੀਆ ਰਹਿ ਸਕਦੇ ਹਾਂ